ਖੇਤੀਬਾੜੀ ਲਈ ਬਿਜਲੀ ਕਨੈਕਸ਼ਨ ਲੈਣਾ ਹੁਣ ਤਾਂ ਜਿਵੇਂ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਵੱਲੋਂ ਬੰਦ ਹੀ ਕਰ ਦਿੱਤੇ ਗਏ ਹਨ ਕਿਉਂਕਿ ਪਾਣੀ ਦਾ ਪੱਧਰ ਦਿਨੋਂ ਦਿਨ ਇਹ ਹੇਠਾਂ ਜਾ ਜਾ ਰਿਹਾ ਹੈ ਜਿਸ ਨਾਲ ਸਾਇੰਸਦਾਨਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਹੋ ਸਕਦਾ ਹੈ ਦੂਸਰੇ ਪਾਸੇ ਜੇਕਰ ਲੋਡ ਵਧਾਉਣ ਦੀ ਗੱਲ ਕਰੀਏ ਤਾਂ ਕੋਈ ਬਹੁਤੀ ਖੱਜਲ ਖੁਆਰੀ ਵਾਲਾ ਨਹੀਂ ਮਸਲਾ ਹੈਗਾ ਸਮੇਂ ਸਮੇਂ 'ਤੇ ਬਿਜਲੀ ਵਿਭਾਗ ਵਾਲੇ ਹਦਾਇਤਾਂ ਕਰਦੇ ਰਹਿੰਦੇ ਹਨ ਕਿਸਾਨਾਂ ਨੂੰ ਜ਼ਿਮੀਦਾਰਾਂ ਨੂੰ ਇਸ਼ਤਿਹਾਰ ਦਿੰਦੇ ਰਹਿੰਦੇ ਹਨ ਅਖਬਾਰਾਂ ਆਦਿ 'ਚ ਬਾਈ ਤੁਸੀਂ ਇਸ ਤਰ੍ਹਾਂ ਕਰਕੇ ਆਹ ਇਸ ਤਰ੍ਹਾਂ ਤੁਸੀਂ ਲੋਡ ਵਧਾ ਸਕਦੇ ਹੋ ਅਤੇ ਉਹ ਜਿਹੜੀਆਂ ਹੈ ਜੋ ਵੀ ਉਹਨਾਂ ਨੇ ਮੰਗਿਆ ਉਹ ਪੂਰਾ ਕਰਕੇ ਅਤੇ ਉਹ ਠੀਕ ਬਹੁਤ ਘੱਟ ਰੇਟ ਨਾਲ ਹੀ ਬਿਜਲੀ ਦਾ ਜਿਹੜਾ ਲੋਡ ਵਧਾਇਆ ਜਾ ਸਕਦਾ ਹੈ ਕੋਈ ਬਹੁਤਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ